ਮੈਂ ਇੱਕ ਨਵੀਂ ਐਪ ਦੀ ਖੋਜ ਕਰ ਸਕਦੀ ਹਾਂ ਜਿਹੜੀ ਕਿ ਰੋਜ਼ਗਾਰ ਦੇ ਰਿਲੇਟਡ ਹੋਏਗੀ ਜਿਹੜੀ ਕਿ ਅਲੱਗ ਅਲੱਗ ਜਗ੍ਹਾ ਤੋਂ ਅਤੇ ਨਵੀਆਂ ਨਵੀਆਂ ਨੌਕਰੀਆਂ ਦੀ ਭਾਲ ਚੱਕੇਗੀ ਅਤੇ ਉਸ ਐਪ 'ਤੇ ਪਾਏਗੀ ਜਿਹੜੇ ਵੀ ਲੋਕ ਉਸ ਆਪ ਨੂੰ ਯੂਸ ਕਰਦੇ ਹੋਣਗੇ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਵੀ ਕਿਹੜੀ ਨੌਕਰੀ ਕਿੱਥੇ ਪ੍ਰੋ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਉਹ ਜਾ ਕੇ ਉੱਥੇ ਨੌਕਰੀ ਕਰ ਸਕਦੇ ਹਨ ਇਸ ਨਾਲ ਬਹੁਤ ਹੀ ਲੋਕਾਂ ਦੀ ਸ਼ ਪਰੇਸ਼ਾਨੀ ਹੱਲ ਹੋ ਸਕਦੀ ਹੈ ਜਿਹੜੇ ਲੋਕ ਬੇਰੋਜ਼ਗਾਰ ਹੈ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਅਤੇ ਜਿਹਨਾਂ ਦੇ ਘਰ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਹੈ ਉਹਨਾਂ ਦੀ ਇਹ ਤੰਗੀ ਵੀ ਦੂਰ ਹੋ ਸਕਦੀ ਹੈ ਮੇਰੀ ਇਹ ਐਪ ਮੈਨੂੰ ਲੱਗਦਾ ਬਹੁਤ ਜ਼ਿਆਦਾ ਮਸ਼ਹੂਰ ਹੋਏਗੀ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਨੌਕਰੀਆਂ ਹਨ ਅਤੇ ਲੋਕਾਂ ਨੂੰ ਨੌਕਰੀ ਦੀ ਬਹੁਤ ਜ਼ਿਆਦਾ ਲੋੜ ਹੈ